ਹਾਂਜੀ ਸਾਡੇ ਪਿੰਡ ਵਿੱਚ ਵੈਸੇ ਤਾਂ ਬਹੁਤ ਸਾਰੀਆਂ ਸਿਖਲਾਈ ਪ੍ਰੋਗਰਾਮ ਜਾਂ ਅਕੈਡਮੀਆਂ ਹਨ ਜਿਨ੍ਹਾਂ ਵਿੱਚ ਕੱਪੜੇ ਸਿਲਾਈ ਕੁਕਿੰਗ ਸਿੰਗਿੰਗ ਅਤੇ ਡਾਂਸ ਵਰਗੀਆਂ ਆਈਟਮ ਸਿਖਾਈਆਂ ਜਾਂਦੀਆਂ ਹਨ ਉਹ ਸਾਨੂੰ ਸਿਖਾਉਂਦੇ ਹਨ ਕਿ ਅਸੀਂ ਡਾਂਸ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਸਭ ਤੋਂ ਪਹਿਲਾਂ ਤਾਂ ਡਾਂਸ ਕਰਨ ਤੋਂ ਪਹਿਲਾਂ ਅਸੀਂ ਜਿਹੜੇ ਵੀ ਗਾਣੇ ਉੱਪਰ ਡਾਂਸ ਕਰਨਾ ਹੈ ਉਸ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਜੋ ਡਾਂਸ ਕਰਦੇ ਸਮੇਂ ਸਾਨੂੰ ਉਸਦੇ ਲਿਰਿਕਸ ਯਾਦ ਰਹਿਣ ਅਤੇ ਲਿਰਿਕਸ ਦੇ ਹਿਸਾਬ ਨਾਲ ਜੋ ਵੀ ਸਟੈਪ ਕਰਨਾ ਹੁੰਦਾ ਹੈ ਉਹ ਸਾਨੂੰ ਉਸ ਟਾਈਮ 'ਤੇ ਯਾਦ ਰਹਿ ਜਾਵੇ ਅਤੇ ਅਸੀਂ ਉਸ ਨੂੰ ਵਧੀਆ ਤਰੀਕੇ ਨਾਲ ਪੇਸ਼ ਕਰ ਲਿਆ ਜਾਵੇ ਡਾਂਸ ਕਰਦੇ ਸਮੇਂ ਸਾਨੂੰ ਇਹ ਵੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਅਸੀਂ ਸਟੇਜ ਨੂੰ ਕਿਸ ਤਰ੍ਹਾਂ ਸਾਰੇ ਗਾਣੇ ਵਿੱਚ ਕਵਰ ਕਰਨਾ ਹੈ ਇੱਕ ਜਗ੍ਹਾ 'ਤੇ ਖੜ ਕੇ ਅਸੀਂ ਡਾਂਸ ਨਹੀਂ ਕਰਨਾ ਜਾਂ ਅਸੀਂ ਜ਼ਿਆਦਾ ਹੀ ਚੱਕਰ ਨਹੀਂ ਕੱਢੇ ਜਾਣੇ ਚਾਹੀਦੇ ਉਹ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹਰ ਛੋਟੀਆਂ ਛੋਟੀਆਂ ਗੱਲਾਂ ਦੱਸਦੇ ਹਨ ਜਿਸ ਨਾਲ ਕਿ ਇੱਕ ਵਧੀਆ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਅਤੇ ਸਾਡੇ ਡਾਂਸ ਦੇ ਹੁਰ ਹੁਨਰ ਨੂੰ ਸੁਧਾਰਿਆ ਵੀ ਕਿੱਦਾਂ ਜਾ ਸਕਦਾ ਹੈ ਜਿਵੇਂ ਕਿ ਅਸੀਂ ਕਿਸੇ ਡਾਂਸ ਦੀ ਰਿਹਾਸਲ ਕਰ ਰਹੇ ਹਾਂ ਤਾਂ ਅਸੀਂ ਵਾਰ ਵਾਰ ਭੁੱਲਦੇ ਜਾ ਰਹੇ ਹਾਂ ਤਾਂ ਸਾਨੂੰ ਉਹ ਕਾਮ ਡਾਊਨ ਹੋਣ ਲਈ ਕਹਿੰਦੇ ਹਨ ਤਾਂ ਕਿ ਅਸੀਂ ਮੈਂਟਲੀ ਤੌਰ 'ਤੇ ਵਧੀਆ ਤਰੀਕੇ ਨਾਲ ਪ੍ਰਿਪੇਅਰ ਹੋ ਕੇ ਵਧੀਆ ਤਰੀਕੇ ਨਾਲ ਅਸੀਂ ਡਾਂਸ ਦੀ ਆਈਟਮ ਨੂੰ ਪੇਸ਼ ਕਰ ਸਕੀਏ ਉਹ ਸਾਨੂੰ ਦੱਸਦੇ ਹਨ ਕਿ ਐਕਸਪ੍ਰੈਸ਼ਨ ਬਹੁਤ ਇਮਪੋਰਟੈਂਟ ਰੋਲ ਪਲੇ ਕਰਦੇ ਹੈਗੇ ਆ ਡਾਂਸ ਵਿੱਚ ਕਿ ਅਸੀਂ ਆਪਣੇ ਮੂੰਹ ਦੇ ਐਕਸਪ੍ਰੈਸ਼ਨ ਕਿੱਦਾਂ ਰੱਖਣੇ ਹਨ ਸਮਾਈਲ ਰੱਖਣੀ ਹੈ ਫੇਸ 'ਤੇ ਐਵੇਂ ਨਹੀਂ ਕਿ ਮੂੰਹ ਬਣਾ ਕੇ ਹੀ ਨੱਚੀ ਜਾਓ ਉਹ ਸਾਨੂੰ ਇਸ ਤਰੀਕੇ ਨਾਲ ਬਹੁਤ ਸਾਰੀਆਂ ਗੱਲਾਂ ਦੱਸਦੇ ਹਨ ਅਤੇ ਇਹ ਸਾਡੇ ਡਾਂਸ ਦੇ ਹੁਨਰ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ ਅਤੇ ਇੱਕ ਵਧੀਆ ਪ੍ਰਦਰਸ਼ਨ ਕਰਨ ਦੀ ਅਗਵਾਈ ਵੀ ਦਿੰਦੇ ਹਨ